ਮੈਂ ਪਹਿਲਾਂ ਵੀ ਬਥੇਰੀਆਂ ਗੇਮਾਂ ਖੇਡੀਆਂ ਹਨ ਜਿਵੇਂ ਫੁਟਬੋਲ ਬਾਸਕਿਟਬੋਲ ਬਟ ਮੇਰਾ ਕ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਦਿਲ ਲੱਗਦਾ ਹੈ ਕਿਉਂਕਿ ਕ੍ਰਿਕਟ ਇੱਕ ਐਸੀ ਹੀ ਖੇਡ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਫੇਮਸ ਹੈ ਅਤੇ ਮੇਰੇ ਪਿਤਾ ਜੀ ਨੂੰ ਵੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਹੈ ਉਹਨਾਂ ਨੇ ਤਾਂ ਆਪਣੇ ਲਈ ਇੱਕ ਪਿੱਚ ਵੀ ਤਿਆਰ ਕਰਵਾ ਰੱਖੀ ਹੈ ਜਿਸਦੇ ਉੱਤੇ ਮੈਂ ਵੀ ਪ੍ਰੈਕਟਿਸ ਕਰਦਾ ਹੁੰਦਾ ਹਾਂ ਜਿਵੇਂ ਕਦੇ ਕਦੇ ਅਗਰ ਮੇਰੀ ਘਰਦਿਆਂ ਨਾਲ ਕੋਈ ਬਹਿਸ ਸੁੜਾਕ ਹੋ ਜਾਂਦੀ ਹੈ ਤਾਂ ਉੱਥੇ ਮੈਂ ਖੇਡਣ ਚਲਾ ਜਾਂਦਾ ਹਾਂ ਅਤੇ ਆਪਣੇ ਸਕੂਲ ਦੇ ਵਿੱਚ ਮੈਂ ਐਸ ਆ ਫਾਸਟ ਬੋਲਰ ਵੀ ਸਲੈਕਟ ਹੋਇਆ ਹਾਂ ਅਤੇ ਮੈਂ ਜੋਨਲ ਵੀ ਖੇਡੇ ਹਨ ਅਤੇ ਉਸਦੇ ਵਿੱਚ ਮੈਂ ਆਪਣੀ ਟੀਮ ਨੂੰ ਮੈਚ ਜਿਤਾਉਣ ਦੀ ਵੀ ਪੂਰੀ ਕੋਸ਼ਿਸ਼ ਕਰੀ ਹੈ ਅਤੇ ਅਸੀਂ ਜਿੱਤੇ ਵੀ ਹਾਂ ਅਤੇ ਹੌਲੀ ਹੌਲੀ ਮੈਂ ਆਪਣੀ ਇਸ ਖੇਡ ਪ੍ਰਤੀ ਮੈਂ ਆਪਣੀ ਪੂਰੀ ਡੈਡੀਕੇਸ਼ਨ ਅਤੇ ਦੇ ਨਾਲ ਅੱਗੇ ਵੱਧ ਰਿਹਾ ਹਾਂ ਜਿਵੇਂ ਕਿ ਮੈਂ ਨੈਸ਼ਨਲ ਵੀ ਖੇਡਣ ਦੀ ਕੋਸ਼ਿਸ਼ ਕਰੀ ਹੈ ਬਟ ਮੈਂ ਖੇ ਸਲੈਕਟ ਨਹੀਂ ਹੋ ਪਾਇਆ ਕਿਉਂਕਿ ਉਹ ਥੋੜ੍ਹੀ ਜੀ ਮੇਰੇ 'ਚ ਕਮੀ ਰਹਿ ਗਈ ਹੈ ਉਸ ਨੂੰ ਦੂਰ ਕਰਨ ਦੇ ਲਈ ਮੈਂ ਦਿਨ ਰਾਤ ਆਪਣੀ ਇਸ ਗੇਮ ਦੇ ਲਈ ਪ੍ਰੈਕਟਿਸ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਅਤੇ ਇਸ ਗੇਮ ਦੇ ਵਿੱਚ ਅੱਗੇ ਹੋਰ ਤਾਂ ਹੋਰ ਜਾਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਜਿਵੇਂ ਕਿ ਟਾਈਮ ਵੱਧ ਨਿਕਲਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਮੇਰੀ ਵੀ ਸਕਿਲ ਵੱਧ ਇਸ ਗੇਮ ਦੇ ਪ੍ਰਤੀ ਵੱਧਦੀ ਜਾ ਰਹੀ ਹੈ ਇਸ ਗੇਮ ਦੇ ਖੇਡਣ ਦੇ ਇਲਾਵਾ ਮੈਨੂੰ ਫੁਟਬੋਲ ਖੇਡਣਾ ਵੀ ਬਹੁਤ ਜ਼ਿਆਦਾ ਪਸੰਦ ਹੈ ਫੁਟਬੋਲ ਖੇਡਣ ਦੇ ਨਾਲ ਮੈਨੂੰ ਮੇਰਾ ਦਿਮਾਗ ਵੀ ਸ਼ਾਂਤ ਹੁੰਦਾ ਹੈ ਅਤੇ ਮੈਂ ਇੱਕ ਹੋਰ ਵੀ ਨਵੀਂ ਗੇਮ ਟਰਾਈ ਕਰ ਪਾਉਂਦਾ ਹਾਂ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਰਲ ਕੇ ਮੈਂ ਉਸ ਗੇਮ ਨਾਲ ਬਹੁਤ ਇੰਜੋਏ ਕਰਦਾ ਹਾਂ ਅਤੇ ਹੌਲੀ ਹੌਲੀ ਮੈਂ ਕ੍ਰਿਕਟ ਪ੍ਰਤੀ ਆਪਣੀ ਪੂਰੀ ਡੈਡੀਕੇਸ਼ਨ ਤੇ ਦਿਖਾ ਕੇ ਉਸਦੇ ਅੰਦਰ ਮੈਂ ਹੋਰ ਅੱਗੇ ਤੋਂ ਅੱਗੇ ਆਪਣੇ ਦੇਸ਼ ਦੇ ਲਈ ਵੀ ਖੇਡਣਾ ਚਾਹਵਾਂਗਾ

ਐਸ ਆ ਫ ਮੈਂ ਐਸ ਆ ਬੈਟਸਮੈਨ ਵੀ ਖੇਡ ਰਿਹਾ ਹਾਂ ਐਸ ਆ ਬੋਲਰ ਵੀ ਖੇਡ ਰਿਹਾ ਐਸ ਆ ਫਿਲਡਰ ਵੀ ਖੇਡ ਰਿਹਾ ਅਤੇ ਮੈਂ ਹੌਲੀ ਹੌਲੀ ਇਸ ਗੇਮ ਨੂੰ ਅੱਗੇ ਵੱਧ ਵੱਧ ਤੋਂ ਵੱਧ ਵਧਾਉਣੀ ਹੈ ਅਤੇ ਵੱਧਦੇ ਹੀ ਚਲੇ ਜਾਣਾ ਹੈ ਅਤੇ ਮੈਂ ਇਸ ਗੇਮ ਨੂੰ ਕਦੇ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਇਹ ਮੇਰਾ ਬਚਪਨ ਦਾ ਸੁਪਨਾ ਹੈ ਕਿ ਮੈਂ ਇੱਕ ਕ੍ਰਿਕਟਰ ਬਣਾਂ ਅਤੇ ਇੱਕ ਮੇਰੇ ਪਿਤਾ ਜੀ ਦਾ ਵੀ ਸੁਪਨਾ ਹੈ ਕਿ ਮੈਂ ਇੱਕ ਕ੍ਰਿਕਟ ਖੇਡਾਂ ਅਤੇ ਦੇਸ਼ ਨੂੰ ਆਪਣੇ ਆਪਣੇ ਦੇਸ਼ ਨੂੰ ਅੱਗੇ ਵਰਲਡ ਵਾਈਡ ਲੈਵਲ 'ਤੇ ਰਿਪ੍ਰਜੈਂਟ ਕਰਾਂ ਅਤੇ ਮੈਂ ਹੋਰ ਤੋਂ ਹੋਰ ਅੱਗੇ ਵਧਦਾ ਜਾਵਾਂ ਅਤੇ ਇਸ ਨੂੰ ਅਤੇ ਮੇਰੀ ਹਰ ਸੁਪਨਾ ਪੂਰਾ ਹੋਵੇ ਅਤੇ ਮੈਂ ਆਪਣੇ ਪਿਤਾ ਜੀ ਦਾ ਵੀ ਸੁਪਨਾ ਕਰ ਪਾ ਪੂਰਾ ਕਰ ਪਾਵਾਂ ਤਾਂ ਕਿ ਜੋ ਮੈਂ ਉਨ ਉਹ ਮੇਰੇ 'ਤੇ ਮਾਨ ਕਰ ਸਕਣ ਅਤੇ ਇਸ ਦੇ ਨਾਲ ਨਾਲ ਮੈਂ ਹੋਰ ਵੀ ਗੇਮਾਂ ਟਰਾਏ ਕਰ ਰਿਹਾ ਹਾਂ ਜਿਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਫਲਤਾ ਮਿਲ ਰਹੀ ਹੈ